ਸਭ ਤੋਂ ਪਹਿਲੀ ਤਸਵੀਰ ਮੈਂ ਆਪਣੇ ਆਪ ਦੀ ਖਿੱਚੀ ਸੀ ਜੋ ਕਿ ਪਹਿਲੀ ਵਾਰ ਆਪਣਾ ਨਵਾਂ ਸਮਾਰਟ ਫੋਨ ਖਰੀਦਣ ਤੋਂ ਬਾਅਦ ਆਪਣੀ ਸੈਲਫੀ ਖਿੱਚੀ ਸੀ ਜੋ ਕਿ ਮੈਂ ਦੋ ਹਜ਼ਾਰ ਸਤਾਰ੍ਹਾਂ ਵਿੱਚ ਪਹਿਲਾ ਸਮਾਰਟਫੋਨ ਲਿਆ ਸੀ ਅਤੇ ਉਸ ਸਮੇਂ ਮੇਰੀ ਉਮਰ ਸਿਰਫ ਸਤਾਰ੍ਹਾਂ ਸਾਲ ਦੀ ਸੀ